ਹੈਲੋ ਤੁਸੀਂ ਸ਼ਰਮਾ ਸਟੋਰ ਤੋ ਬੋਲ ਰਹੇ ਹੋ ਜੀ ਤੇ ਸਾਨੂੰ ਬਰਤਨ ਚਾਹੀਦੇ ਸੀਗੇ ਤੇ ਕੀ ਹਾਂਜੀ ਸੀ ਮਤਲਬ ਜੀ ਹੈਵੀ ਹੋਣ ਥੋੜੇ ਜਿਹੇ ਵਧੀਆ ਹੋਣ ਆਵੇ ਵੀ ਲੈਣ ਆਲੇ ਜਿਵੇਂ ਕੂਕਰ ਹੋਗੇ ਵਧੀਆ ਢੋਲੀਆਂ ਸਾਈਜ ਕਿੰਨਾ ਸਾਰਾ ਕੁਝ ਵਧੀਆ ਹੋਵੇ ਹੁੰ ਵਧੀਆ ਡਿਜ਼ਾਇਨਿੰਗ ਹੋਵੇ ਉਹਨਾਂ ਦੀ ਕਿਸ ਰੇਟ ਤੱਕ ਕੀ ਰੇਟ ਚਲਦਾ ਆਪਣਾ

ਹਾਂ ਨੋਨ ਸਟਿਕ ਵੀ ਮਿਲ ਜਾਣਗੇ ਨੋਨ ਸਟਿਕ ਵੀ ਮਿਲ ਜਾਣਗੇ ਅੱਛਾ ਚਲੋ ਸਟਿਲ ਦੇ ਨੇਗੇ ਠੀਕ ਹੈ ਔਫਲਾਈਨ ਬਿਲਿੰਗ ਹੋਵੇਗੀ ਜਾਂ ਆਨਲਾਈਨ ਪੇਮੈਂਟ ਔਫਲਾਈਨ ਕਰਦੇ ਹੋ ਜਾਂ ਆਨਲਾਈਨ ਅੱਛਾ ਔਫਲਾਈਨ ਤੇ ਕੋਈ ਡਿਸਕਾਊਂਟ ਹੈ ਤਾ ਤੁਸੀਂ ਡਿਸਕਾਉਂਟ ਦਿੰਦੇ ਹੋ ਡਿਸਕਾਉਂਟ ਕੋਈ ਨੀ ਤੇ ਆਨਲਾਈਨ ਤੇ ਡਿਲੀਵਰੀ ਚਾਰਜ ਕੀ ਹੋਊਗਾ ਦਿਵਾਲੀ 'ਤੇ ਆਫਰ ਲੱਗਾ ਰਹੇ ਹੋ ਠੀਕ ਅਸੀਂ ਇਕ ਵਾਰ ਤੁਹਾਡੀ ਦੁਕਾਨ 'ਤੇ ਆਉਣਾ ਸੀ ਸਮਾਨ ਦੇਖਣ ਵਾਸਤੇ ਕਿਸ ਟਾਈਮ ਖੁੱਲ ਜਾਂਦੀ ਦੁਕਾਨ ਸੁਬਹ ਅੱਛਾ ਕਿੰਨੇ ਵਜੇ ਤੱਕ ਠੀਕ ਹੈ ਓਕੇ ਫਿਰ ਅਸੀਂ ਦੁਕਾਨ 'ਤੇ ਆਵਾਂਗੇ